ਸਤਿ ਸ਼੍ਰੀ ਅਕਾਲ ਜੀ ਹਾਂਜੀ ਵੈਲਕਮ ਮੋਡਲ ਹਾਂਜੀ ਮੈਂ ਨਾ ਦੋ ਸਬਜ਼ੀਆਂ ਅਤੇ ਰੋਟੀਆਂ ਅਤੇ ਚਾਵਲ ਭੇਜੇ ਸੀਗੇ ਤੁਹਾਨੂੰ ਔਡਰ ਕੀਤਾ ਸੀਗਾ ਅਤੇ ਮੈਂ ਅੱਧੇ ਘੰਟੇ ਬਾਅਦ ਤੁਸੀਂ ਸਾਨੂੰ ਕਿਹਾ ਸੀ ਪਹੁੰਚ ਜਾਣਾ ਇਹ ਤਾਂ ਹੁਣ ਦੋ ਘੰਟੇ ਹੋ ਗਏ ਹੈ ਪਹੁੰਚਿਆ ਹੀ ਨਹੀਂ ਤੁਸੀਂ ਵੈਸੇ ਓਧਰ ਤੁਹਾਡਾ ਆਉਂਦਾ ਪਿਆ ਵਾ ਵੀ ਡਿਲਵਰ ਹੋ ਚੁੱਕਾ ਵਾ ਅਤੇ ਪਰ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤਾਂ ਕਰਕੇ ਤੁਸੀਂ ਉਹਨਾਂ ਨੂੰ ਜਾਂ ਤਾਂ ਤੁਸੀਂ ਬੰਦੇ ਨੂੰ ਪੁੱਛੋ ਵੀ ਜਿਹੜੇ ਬੰਦੇ ਨੂੰ ਭੇਜਿਆ ਸੀਗਾ ਉਹਨੂੰ ਪੁੱਛੋ ਕਿੱਦਾਂ ਕ ਕੀਤਾ ਵਾ ਜਾ ਕੁਛ ਵਾ ਜਾ ਜਾ ਸਾਡੇ ਪੈਸੇ ਕੱਟ ਹੁਣ ਪ੍ਰੋਹਣੇ ਸਾਡੇ ਬੈਠੇ ਆ ਉਹਨਾਂ ਨੇ ਖਾਣਾ ਸੀਗਾ ਤਾਂ ਕਰਕੇ ਮੈਨੂੰ ਬਹੁਤ ਮੁਸ਼ਕਿਲ ਹੋਈ ਪਈ ਹੈ ਤਾਂ ਕਰਕੇ ਕਿੱਦਾਂ ਤੁਸੀਂ ਸਾਡੇ ਪੈਸੇ ਸਾਨੂੰ ਵਾਪਸ ਕਰੋ ਜਾਂ ਕੁਛ ਆ ਜਾਂ ਕੱਟ ਦੋ ਜਾਂ ਕੁਛ ਇੱਦਾਂ ਹਾਂਜੀ ਠੀਕ ਹੈ